ਸਤਿ ਸ਼੍ਰੀ ਅਕਾਲ ਸਰ ਮੇਰਾ ਨਾਮ ਆਰਤੀ ਮੈਂ ਪਠਾਨਕੋਟ ਤੋਂ ਬੋਲਦੀ ਪਈ ਹਾਂ ਵਾਤਾਵਰਨ ਬਾਰੇ ਦੱਸਿਆ ਜਾਵੇ ਤਾਂ ਸਾਡੇ ਪਿੱਛੇ ਜਿਹੇ ਇੱਥੇ ਮੁਕੇਰੀਆਂ ਦੇ ਪਿੰਡ ਵਿੱਚ ਬਹੁਤ ਸਾਰਾ ਪਲੱਡ ਆਇਆ ਸੀ ਜਿਸ ਤਰ੍ਹਾਂ ਕਿ ਪੁੱਲ ਟੁੱਟ ਗਏ ਪੁੱਲ ਟੁੱਟਣ ਕਾਰਣ ਲੋਕਾਂ ਦਾ ਘਰਾਂ ਵਿਚਾਰਿਆਂ ਦੇ ਪਾਣੀ ਵੜ੍ਹ ਗਿਆ ਪਾਣੀ ਵੜ੍ਹਣ ਕਾਰਣ ਬਹੁਤ ਸਾਰਾ ਤਬਾਹ ਹੋਇਆ ਹੁੰਦਾ ਜਿਸ ਤਰ੍ਹਾਂ ਕਿ ਖੇਤੀਬਾੜੀ ਵੀ ਰੁੜ੍ਹ ਗਈ ਉਨ੍ਹਾਂ ਦੀ ਅਤੇ ਤਬਾਈ ਬਾਰੇ ਦੱਸਿਆ ਜਾਵੇ ਤਾਂ ਬਹੁਤ ਸਾਰਾ ਨੁਕਸਾਨ ਹੋਇਆ ਉਨ੍ਹਾਂ ਦਾ ਜਿਸ ਤਰ੍ਹਾਂ ਕਿ ਘਰਾਂ ਵਿੱਚ ਪਾਣੀ ਵੜ੍ਹ ਗਏ ਪਾਣੀ ਆਉਣ ਕਾਰਣ ਕਈਆਂ ਦੇ ਘਰ ਵੀ ਰੁੜ੍ਹ ਗਏ ਔਰ ਕਈਆਂ ਦੀ ਖੇਤੀ ਸਾਰੀ ਬਰਬਾਦ ਹੋ ਗਈ ਇਸ ਕਰਕੇ ਘਟਨਾਵਾਂ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਕਿ ਸਾਡੇ ਮੁਕੇਰੀਆਂ ਵਿੱਚ ਚੰਡੀਗੜ੍ਹ ਸ਼ਹਿਰ ਵਿੱਚ ਬਹੁਤ ਸਾਰਾ ਪਾਣੀ ਆਇਆ ਜਾਣੀ ਕਿ ਪਾਣੀ ਵੱਧ ਤੋਂ ਵੱਧ ਆਇਆ ਕਿ ਉਨ੍ਹਾਂ ਦੇ ਜੋ ਉੱਪਰੇ ਫਲੱਡ ਨਿੱਚਲੇ ਫਲੱਡ ਸਭ ਰੁੜ੍ਹ ਗਏ ਔਰ ਬਹੁਤ ਸਾਰਾ ਲੋਕਾਂ ਨੁਕਸਾਨ ਹੋਇਆ ਤਬਾਹੀ ਮਚਾਈ ਹੋਈ ਹੈ ਔਰ ਕੁਛ ਪਠਾਨਕੋਟ ਵਿੱਚ ਘਰਾਂ ਵਿੱਚ ਪਾਣੀ ਆ ਗਿਆ ਜਿਸ ਤਰ੍ਹਾਂ ਕਿ ਪਠਾਨਕੋਟ ਵਾਲਾ ਪੁੱਲ ਹੈ ਉੱਥੇ ਆਣਾ ਜਾਉਣਾ ਮੁਸ਼ਕਿਲ ਹੋ ਗਿਆ ਲੋਕਾਂ ਨੂੰ ਜਿਸ ਤਰ੍ਹਾਂ ਕਿ ਬੱਸਾਂ ਗੱਡੀਆਂ ਬੰਦ ਹੋ ਗਈਆਂ ਉਨ੍ਹਾਂ ਦਾ ਜਾਣਾ ਬਹੁਤ ਜ਼ਿਆਦਾ ਮੁਸ਼ਕਿਲ ਹੋ ਗਿਆ ਇੱਧਰ ਉੱਧਰ ਹੈ ਨਾ ਔਰ ਜਿਸ ਤਰ੍ਹਾਂ ਦੱਸਿਆ ਜਾਵੇ ਕਿ ਸਾਡੇ ਸੁਜਾਨਪੁਰ ਦੇ ਪਿੰਡ ਵਿੱਚ ਪਿੰਡ ਪੈਂਦਾ ਹੈ ਅੱਗੇ ਇੱਥੇ ਜੀਜਪੁਰ ਉੱਥੇ ਵੀ ਬਹੁਤ ਸਾਰਾ ਪਾਣੀ ਆਇਆ ਮਾਤਾ ਦੇ ਬਾਗ ਦੇ ਕੋਲ ਜਿਸ ਤਰ੍ਹਾਂ ਹੋਰ ਵੀ ਲਾਗੇ ਲਾਗੇ ਛੋਟੇ ਛੋਟੇ ਪਿੰਡ ਹੈ ਉਨ੍ਹਾਂ ਦਾ ਬਹੁਤ ਜੀਣਾ ਮੁਸ਼ਕਿਲ ਹੋ ਗਿਆ ਜਦੋਂ ਕਿ ਇਤਨੀ ਜ਼ਿਆਦੀ ਤਬਾਹੀ ਆਈ ਕਿ ਉਨ੍ਹਾਂ ਦੇ ਖੇਤ ਖੇਤ ਵੀ ਸਾਰੇ ਰੁੜ੍ਹ ਗਏ ਵਿਚਾਰਿਆਂ ਦੇ ਔਰ ਵੀ ਕੁਛ ਜਿਸ ਦਾ ਨੁਕਸਾਨ ਹੋ ਗਿਆ ਉਹਨਾਂ ਦੀ ਖੇਤੀਆਂ ਦਾ ਹੈ ਨਾ ਔਰ ਜਿਸ ਤਰ੍ਹਾਂ ਕਿ ਬਹੁਤ ਸਾਰਾ ਨੁਕਸਾਨ ਹੋਇਆ ਸਰ ਥੈਂਕਿ ਊ ਓਕੇ ਸਰ